ਬਾਈਕਿੰਗ ਆਪਾਂ ਅੱਜ ਆਪਦੀ ਜ਼ਿੰਦਗੀ ਵਿੱਚ ਜਦੋਂ ਵੀ ਕਦੇ ਵੀ ਸਫਰ ਕਰਦੇ ਹਾਂ ਬਹੁਤ ਹੀ ਸਾਧਨ ਹਨ ਸਫਰ ਕਰਨ ਦੇ ਜਿਵੇਂ ਕਾਰ 'ਤੇ ਕੀਤਾ ਜਾ ਸਕਦਾ ਟ੍ਰੇਨ 'ਤੇ ਕੀਤਾ ਜਾ ਸਕਦਾ ਵਾਟਰ ਵਾਟਰ ਬੇਸ 'ਤੇ ਸਫਰ ਕੀਤਾ ਜਾ ਸਕਦਾ ਰੇਲ ਬੇਸਡ ਕੀਤਾ ਜਾ ਸਕਦਾ ਨਾ ਉਸ ਇੱਕ ਤਰ੍ਹਾਂ ਜਿਹੜਾ ਰੋਡਵੇਜ਼ ਹੈ ਰੋਡਵੇਜ਼ ਦੇ ਵਿੱਚ ਵੀ ਵੱਖ ਵੱਖ ਪ੍ਰਕਾਰ ਦੇ ਸਾਧਨਾਂ ਵਾਲਾ ਆਪਾਂ ਸਫਰ ਕਰ ਸਕਦੇ ਹਾਂ ਜਿਵੇਂ ਕਿ ਬੱਸ ਕਾਰ ਸਕੂਟਰ ਬਾਈਕ ਆਦਿ ਪਰ ਮੈਨੂੰ ਆਪਣੀ ਪਰਸਨਲ ਲਾਈਫ ਵਿੱਚ ਬਾਈਕ 'ਤੇ ਸਫਰ ਕਰਨਾ ਸਭ ਤੋਂ ਵਧੀਆ ਲੱਗਦਾ ਹੈ ਉਸਦਾ ਕਾਰਨ ਹੈ ਕਿ ਬਾਈਕਿੰਗ ਜਦੋਂ ਕਰਦੇ ਹਾਂ ਤਾਂ ਆਪਾਂ ਨੂੰ ਜਿਵੇਂ ਜਿਵੇਂ ਆਪਾਂ ਖੇਤਰ ਟੱਪਦੇ ਰਹਿੰਦੇ ਹਾਂ ਤਾਂ ਆਪਾਂ ਨੂੰ ਅੱਡ ਅੱਡ ਤਰ੍ਹਾਂ ਦਾ ਉੱਥੋਂ ਦਾ ਇਨਵਾਇਰਮੈਂਟ ਵਾਤਾਵਰਨ ਐਟਮੋਸਫੇਅਰ ਨੂੰ ਫੀਲ ਕਰ ਸਕਦੇ ਹਾਂ ਖੁੱਲ੍ਹ ਕੇ ਜੋ ਕਿ ਆਪਾਂ ਇੱਕ ਬੰਦ ਕਾਰ ਦੇ ਏ ਸੀ ਚੱਲਦੇ 'ਚ ਜਾਂ ਸਰਦੀਆਂ 'ਚ ਬਿਨਾ ਏ ਸੀ ਚੱਲਦੇ ਵਿੱਚ ਮਹਿਸੂਸ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਸਫਰ ਕਰਦੇ ਹਾਂ ਮੋਟਰਸਾਈਕਲ 'ਤੇ ਤਾਂ ਆਪਾਂ ਐਕਟਿਵ ਫੁੱਲ ਐਕਟਿਵ ਹੋ ਕੇ ਚ ਚਲਾਉਂਦੇ ਹਾਂ ਜਿਸ ਨਾਲ ਆਪਣੀ ਕਨਸਟਰੇਸ਼ਨ ਵੀ ਵੱਧਦੀ ਹੈ ਅਤੇ ਜਦੋਂ ਵੀ ਆਪਾਂ ਰੋਡ ਸਾਈਡ ਢਾਬੇ 'ਤੇ ਖੜ੍ਹਦੇ ਹਾਂ ਪਾਰਕਿੰਗ ਦੀ ਸੁਵਿਧਾ ਆਪਾਂ ਨੂੰ ਜ਼ਿਆਦਾ ਨਹੀਂ ਚਾਹੀਦੀ ਹੁੰਦੀ ਕਾਰ ਦੇ ਲਈ ਜਾਂ ਹੋਰ ਲਈ ਆਪਾਂ ਨੂੰ ਕਾਫੀ ਚਾਹੀਦੀ ਹੁੰਦੀ ਹੈ ਸੋ ਬਾਈਕਿੰਗ ਦੇ ਲਈ ਆਪਾਂ ਵੱਖ ਵੱਖ ਢਾਬਿਆਂ 'ਤੇ ਜਾਂਦੇ ਹਾਂ ਉੱਥੇ ਜਾ ਕੇ ਅੱਡ ਅੱਡ ਤਰ੍ਹਾਂ ਦਾ ਭੋਜਨ ਸੇਵਨ ਕਰਦੇ ਹਾਂ ਪਰ ਬਾਈਕਿੰਗ ਦੌਰਾਨ ਮੈਂ ਭੋਜਨ ਖਾਣਾ ਪਸੰਦ ਜੋ ਵੀ ਕਰਦਾ ਹਾਂ ਉਹ ਇੱਕ ਮੈਂ ਲਾਈਟ ਫੂਡ ਲੈਂਦਾ ਹਾਂ ਜਿਵੇਂ ਕਿ ਸਾਂਬਰ ਇਡਲੀ ਦਾਲ ਨਾਲ ਫੁਲਕਾ ਤਾਂ ਕਿ ਪਰਾਂਠੇ ਵਗੈਰਾ ਨਹੀਂ ਕੋਈ ਅਜਿਹੀ ਚੀਜ਼ ਨਹੀਂ ਫਰਾਈਡ ਖਾਈ ਦੀ ਜਿਸ ਨਾਲ ਮੈਨੂੰ ਨੀਂਦ ਆਵੇ ਸੋ ਇਸ ਲਈ ਮੈਂ ਬਾਈਕਿੰਗ ਦੇ ਦੌਰਾਨ ਹਲਕਾ ਭੋਜਨ ਹੀ ਖਾਣਾ ਪਸੰਦ ਕਰਦਾ ਹਾਂ ਹਾਂ ਬਾਈਕਿੰਗ ਯਾਤਰਾ ਦੌਰਾਨ ਪਿੱਠ ਅਤੇ ਮੋਢੇ ਦੇ ਦਰਦ ਅਨੁਬਾਬ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਬਾਈਕ 'ਤੇ ਜਾ ਰਹੇ ਹੋ ਅਗਰ ਤੁਸੀਂ ਵਧੀਆ ਸਪੋਰਟਸ ਪੂਰੀ ਹਿਮਾਲਿਅਨ ਬਾਈਕ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਦੀ ਸਮੱਸਿਆ ਨਹੀਂ ਆਵੇਗੀ ਸ਼ੁਰੂਆਤੀ ਖੇਤਰ ਵਿੱਚ ਅਗਰ ਆਪਾਂ ਡੇਲੀ ਰੂਟੀਨ ਦੇ ਬਾਈਕ ਨੂੰ ਪਹਾੜਾਂ 'ਤੇ ਲੈ ਕੇ ਜਾਵਾਂਗੇ ਤਾਂ ਇਹ ਸਮੱਸਿਆ ਆਉਣੀ ਸੰਮਭ ਸੰਭਵ ਹੈ ਸੋ ਇਸ ਲਈ ਬਾਹੀ ਬਾਈਕਿੰਗ ਦਾ ਸਫਰ ਕਰਨਾ ਸਿਹਤ ਲਈ ਬਹੁਤ ਅੱਛੀ ਚੀਜ਼ ਹੈ